ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਤੁਸੀਂ ਓਲਾ ਕੈਬ ਸਰਵਿਸ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਵੀਰ ਜੀ ਮੈਨੂੰ ਨਾ ਇੱਕ ਕੈਬ ਬੁੱਕ ਕਰਨੀ ਸੀ ਹਾਂਜੀ ਹਾਂਜੀ ਜਲੰਧਰ ਤੋਂ ਅੰਮ੍ਰਿਤਸਰ ਹਾਂਜੀ ਜ ਹਾਂਜੀ ਉੱਥੇ ਜਲੰਧਰ 'ਚ ਨਾ ਮੇਰੇ ਮਾਤਾ ਜੀ ਅਤੇ ਮੇਰਾ ਇੱਕ ਦੋਸਤ ਰਹਿੰਦਾ ਵਾ ਅਤੇ ਉਹਨਾਂ ਨੂੰ ਇੱਥੇ ਅੰਮ੍ਰਿਤਸਰ ਲਿਆਉਣਾ ਵਾ ਮੇਰੇ ਘਰ ਤਾਂ ਇਸ ਲਈ ਮੈਨੂੰ ਕੈਬ ਬੁੱਕ ਕਰਨੀ ਸੀ ਅਤੇ ਮੈਂ ਪੁੱਛਣਾ ਸੀ ਕਿੰਨੇ ਟਾਈਮ ਤੱਕ ਮਤਲਬ ਤੁਸੀਂ ਆ ਜਾਓਗੇ ਅੰਮ੍ਰਿਤਸਰ ਅਤੇ ਕੀ ਕੈਬ ਪ੍ਰਾਈਜ਼ ਵਗੈਰਾ ਕੀ ਹੈ ਰੇ ਰੇਟ ਵਗੈਰਾ ਹਾਂਜੀ ਹਾਂਜੀ ਨਹੀਂ ਨਹੀਂ ਉਹਨਾਂ ਕੋਲ ਸਮਾਨ ਹੈਗਾ ਨਾਲ ਲੱਗੇਜ਼ ਵੀ ਆ ਅਤੇ ਉਹਨਾਂ ਨੂੰ ਮਤਲਬ ਤੁਸੀਂ ਦੱਸਦੋ ਕਿੰਨੇ ਵਜੇ ਉੱਥੋਂ ਪਿਕਅੱਪ ਕਰੋਗੇ ਤੁਸੀਂ ਅਤੇ ਕਿੰਨੇ ਵਜੇ ਇੱਥੇ ਅੰਮ੍ਰਿਤਸਰ ਸਾਨੂੰ ਡਰੋਪ ਕਰ ਦਿਓਗੇ ਉਹਨਾਂ ਨੂੰ ਹਾਂਜੀ ਨਹੀਂ ਨਹੀਂ ਮੈਂ ਐਡਰੈੱਸ ਤੁਹਾਨੂੰ ਐੱਸਮੈੱਸ ਕਰਦਾਂਗੀ ਜਾਂ ਵਟਸਐੱਪ ਕਰਦਾਂਗੀ ਅਤੇ ਤੁਸੀਂ ਦੱਸ ਦਿਓ ਮੈਨੂੰ ਕਿੰਨਾ ਟਾਈਮ ਲੱਗਣਾ ਵਾ ਅਤੇ ਆਪਣਾ ਰੇਟ ਵੀ ਦੱਸਦੋ ਕਿ ਮਤਲਬ ਕਿੰਨਾ ਪ੍ਰਾਈਜ਼ ਲੱਗੇਗਾ ਉੱਥੋਂ ਤੋਂ ਲੈ ਕੇ ਇੱਥੋਂ ਤੱਕ ਆਉਣ 'ਚ

ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਤੁਸੀਂ ਨਾ ਮੈਨੂੰ ਆਪਣਾ ਨੰਬਰ ਮਤਲਬ ਆਪਣਾ ਖ਼ੁਦ ਦਾ ਪਰਸਨਲ ਨੰਬਰ ਦੇ ਦਿਓ ਇਹ ਤਾਂ ਤੁਹਾਡੀ ਇੱਧਰ ਸਰਵਿਸ ਸੈਂਟਰ ਦਾ ਹੈ ਨਾ ਹਾਂਜੀ ਤੁਸੀਂ ਮੈਨੂੰ ਆਪਣਾ ਪਰਸਨਲ ਨੰਬਰ ਦੇ ਦਿਓ ਮੈਂ ਉਹਦੇ 'ਤੇ ਤੁਹਾਨੂੰ ਅਡਰੈੱਸ ਐਸਮੈੱਸ ਕਰ ਦਿੰਦੀ ਹਾਂ ਹਾਂਜੀ ਹਾਂਜੀ ਕੱਲ੍ਹ ਸਵੇਰੇ ਤੁਸੀਂ ਉਹਨਾਂ ਨੂੰ ਉੱਥੋਂ ਪਿੱਕ ਕਰਨਾ ਵਾ ਤਾਂ ਦੱਸ ਦਿਓ ਕਿੰਨੇ ਵਜੇ ਕਰੋਗੇ ਹਾਂਜੀ ਉਹਨਾਂ ਨੇ ਕੱਲ੍ਹ ਆਉਣਾ ਵਾ ਓਕੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਓਕੇ ਥੈਂਕ ਯੂ ਧੰਨਵਾਦ ਧੰਨਵਾਦ